ਯੋਗਾ ਵੱਖਰੀ ਵੱਖਰੀ ਉਮਰਾਂ ਅਤੇ ਯੋਗਤਾਵਾਂ ਦੇ ਲੋਕਾਂ ਨੂੰ ਬਹੁਤ ਲਾਭ ਪਹੁੰਚਾ ਸਕਦਾ ਹੈ ਇਹ ਛੋਟੇ ਬੱਚਿਆਂ ਨੂੰ ਸਰੀਰਿਕ ਵਿਕਾਸ ਲਈ ਲਾਭਦਾਇਕ ਹੋ ਸਕਦਾ ਹੈ ਮੱਧ ਵਰਗੀ ਲੋਕਾਂ ਲਈ ਇਹ ਟੈਨਸ਼ਨ ਤੋਂ ਰਾਹਤ ਪਾਉਣ ਦਾ ਮਾਧਿਅਮ ਹੋ ਸਕਦਾ ਹੈ ਅਤੇ ਜਿਹੜੇ ਸੀਨੀਅਰ ਸਿਟੀਜਨ ਹਨ ਉਹਨਾਂ ਲਈ ਇਹ ਉੱਚ ਵਿਚਾਰ ਰੱਖਣ ਦਾ ਮਾਧਿਅਮ ਹੋ ਸਕਦਾ ਹੈ